ਹੈਲੋ ਹੈਲੋ ਮੈਂ ਨਾ ਸੁਮਿਤ ਦੇ ਸਕੂਲੋਂ ਬੋਲਦੀ ਪਈ ਹਾਂ ਹੈਲੋ ਹੈਲੋ ਮੈਂ ਸੁਮਿਤ ਸਕੂਲੋਂ ਬੋਲਦੀ ਪਈ ਹਾਂ ਸੁਮਿਤ ਨੂੰ ਨਾ ਕਾਫ਼ੀ ਤੇਜ਼ ਬੁਖਾਰ ਹੋ ਗਿਆ ਅਤੇ ਅਸੀਂ ਉਹਨੂੰ ਨਾ ਕਲਾਸ ਵਿੱਚ ਬਿਠਾਇਆ ਹੈ ਮਗਰ ਉਹ ਕੰਟਰੋਲ ਨਹੀਂ ਹੋ ਰਿਹਾ ਪਹਿਲਾਂ ਅਸਾਂ ਮੈਡੀਸਨ ਵੀ ਦਿੱਤੀ ਹੈ ਅਤੇ ਨਾਲੇ ਹੋਰ ਵੀ ਕਈ ਹੋਰ ਵੀ ਕਈ ਤਰ੍ਹਾਂ ਦੇ ਉਪਚਾਰ ਕੀਤੇ ਆ ਅਤੇ ਮੈਡੀਸਨ ਦੇ ਕੇ ਵੀ ਉਹਨੂੰ ਨਾ ਉਹਦਾ ਉਹਦਾ ਬੁਖ਼ਾਰ ਰਿਕਵਰ ਨਹੀਂ ਕਰ ਰਿਹਾ ਉਹਨੂੰ ਤੁਸੀਂ ਨਾ ਉਹਨੂੰ ਤੁਸੀਂ ਲੈਣ ਆ ਜਾਓ ਅਤੇ ਮੋਰ ਦੈਨ ਉਨ ਉਹਨੂੰ ਅੱਛਾ ਜੀ ਉਹਨੂੰ ਮੋਰ ਦੈਨ ਹੰਡਰਡ ਤੋਂ ਹੰਡਰਡ ਬੁਖ਼ਾਰ ਹੋ ਰਿਹਾ ਕੁਛ ਇੱਦਾਂ ਹੀ ਕਰ ਰਿਹਾ ਜੇ ਹੈਂਜੀ ਠੀਕ ਹੈਐ ਤੁਸੀਂ ਕਿੱਥੇ ਰਹਿੰਦੇ ਹੋ ਠੀਕ ਠੀਕ ਹੈ ਓਕੇ ਜੀ ਆ ਜਾਣਾ ਠੀਕ ਹੈ ਠੀਕ ਹੈ ਜੀ ਥੈਂਕ ਯੂ